ਮੈਂ ਅਜੇ ਤੱਕ ਢੋਕਲਾ ਨਹੀਂ ਬਣਾਇਆ ਮੇਰੇ ਬੱਚੇ ਤਾਂ ਬਣਾਉਂਦੇ ਹਨ ਪਰ ਇੰਨਾਂ ਸਵਾਦ ਨਹੀਂ ਬਣਾਉਂਦੇ ਜਿੰਨਾਂ ਬਜ਼ਾਰ ਵਿੱਚ ਬਣਿਆ ਹੋਇਆ ਮਿਲਦਾ ਹੈ ਮੈਂ ਚਾਹੁੰਦੀ ਹਾਂ ਕਿ ਮੈਂ ਵੀ ਢੋਕਲਾ ਬਣਾਉਣਾ ਸਿੱਖਾਂ ਤਾਂ ਕਿ ਮੈਂ ਬੱਚਿਆਂ ਨਾਲੋਂ ਵੀ ਵਧੀਆ ਬਣਾ ਸਕਾਂ ਬੱਚੇ ਜਦ ਬਣਾਉਂਦੇ ਹਨ ਤਾਂ ਕਦੇ ਕਦੇ ਢੋਕਲੇ ਵਿੱਚ ਕੜੱਤਣ ਆ ਜਾਂਦੀ ਹੈ ਮੈਂ ਸਿੱਖਣਾ ਚਾਹੁੰਦੀ ਹਾਂ ਕਿ ਇਹ ਕੜੱਤਣ ਕਿਉਂ ਆਈ ਅਤੇ ਕੀ ਪਾਇਆ ਜਾਵੇ ਤਾਂ ਕਿ ਇਹ ਢੋਕਲਾ ਜ਼ਿਆਦਾ ਸਵਾਦ ਬਣੇ ਅਤੇ ਮੇਰੇ ਬੱਚਿਆਂ ਨੂੰ ਪਸੰਦ ਆਵੇ ਮੇਰੇ ਬੱਚੇ ਢੋਕਲਾ ਖਾਣ ਦੇ ਬਹੁਤ ਸ਼ੌਕੀਨ ਹਨ ਪਰ ਜਦ ਘਰ ਵਿੱਚ ਬੱਚੇ ਬਣਾਉਂਦੇ ਹਨ ਤਾਂ ਛੋਟੇ ਬੱਚਿਆਂ ਨੂੰ ਬਿਲਕੁਲ ਹੀ ਪਸੰਦ ਨਹੀਂ ਆਉਂਦਾ ਕਦੇ ਢੋਕਲੇ ਵਿੱਚ ਮਿੱਠਾ ਜ਼ਿਆਦਾ ਹੋ ਜਾਂਦਾ ਹੈ ਅਤੇ ਕਦੇ ਉਸ ਵਿੱਚ ਜੂਸੀ ਜੂਸੀਪਣ ਨਹੀਂ ਹੁੰਦਾ ਅਤੇ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਖੁਦ ਸਿੱਖਾਂ ਅਤੇ ਮੈਂ ਬਣਾ ਕੇ ਬੱਚਿਆਂ ਨੂੰ ਖਵਾਵਾਂ ਤਾਂ ਕਿ ਮੇਰੇ ਬੱਚੇ ਖੁਸ਼ ਹੋ ਜਾਣ ਵੀ ਦਾਦੀ ਦਾ ਬਣਿਆ ਹੋਇਆ ਢੋਕਲਾ ਖਾ ਕੇ